ਸੌਲਾਂ ਅਗਸਤ ਉੱਨੀ ਸੌ ਚੁਰਾਸੀ ਛੇ ਨਵੰਬਰ ਉੱਨੀ ਸੌ ਬਿਆਸੀ ਪੰਦਰਾਂ ਮਾਰਚ ਦੋ ਹਜ਼ਾਰ ਇੱਕ ਦੋ ਮਈ ਦੋ ਹਜ਼ਾਰ ਤਿੰਨ ਦਸੰਬਰ ਉੱਨੀ ਸੌ ਛਿਆਸੀ